ਬੱਚੇ ਦੇ ਜਨਮ 'ਤੇ ਘਰ ਦੇ ਦਰਵਾਜ਼ੇ 'ਤੇ ਅੱਕ ਬੰਨ੍ਹੀ ਜਾਂਦੀ ਹਨ ਤਾਂ ਕਿ ਘਰ ਵਿੱਚ ਕੋਈ ਵੀ ਬੁਰੀ ਨਜ਼ਰ ਨਾ ਆਵੇ ਜਨਮ ਤੋਂ ਅੱਠ ਜਾਂ ਦਸ ਦਿਨ ਬਾਅਦ ਬੱਚੇ ਅਤੇ ਮਾਂ ਨੂੰ ਬਾਹਰ ਕੱਢਿਆ ਜਾ ਨਹਾਇਆ ਜਾਂਦਾ ਹੈ ਭਾਵ ਕਿ ਰੀਤ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬੱਚੇ ਦੇ ਨਾਮਕਰਨ ਦੀ ਰਸਮ ਹੁੰਦੀ ਹੈ ਘਰ ਵਿੱਚ ਕਿੰਨਰ ਨੱਚਣ ਆਉਂਦੇ ਹਨ ਬੱਚੇ ਦੀ ਪਹਿਲੀ ਲੋਹੜੀ ਵੰਡੀ ਜਾਂਦੀ ਹੈ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ